ਨਹੀਂ ਮੈਨੂੰ ਨਹੀਂ ਲੱਗਦਾ ਕਿ ਨਿਊਜ਼ ਮੀਡੀਆ ਪੇਂਡੂ ਖੇਤਰਾਂ ਲਈ ਕਾਫੀ ਮੁੱਦੇ ਦਿਖਾਉਂਦਾ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ ਜਿਵੇਂ ਕਿ ਸਾਨੂੰ ਕਿਸੇ ਵੀ ਚੀਜ਼ ਲਈ ਘੱਟ ਤੋਂ ਘੱਟ ਚੀਜ਼ ਲੈਣ ਲਈ ਵੀ ਸਾਨੂੰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਹੈ ਅਤੇ ਇਵੇਂ ਹੀ ਨਾ ਹੀ ਪਿੰਡਾਂ ਦੇ ਵਿੱਚ ਕੋਈ ਬੱਸ ਆਉਣ ਜਾਣ ਦਾ ਟਾਈਮ ਹੈ ਅਤੇ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਨੇ ਅਤੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਜਿਵੇਂ ਕਿ ਹੋਰ ਵੀ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਕੋਈ ਤਰ੍ਹਾਂ ਦੀ ਐਮਰਜੈਂਸੀ ਹੌਸਪਿਟਲ ਲਈ ਜਾਣਾ ਹੁੰਦਾ ਤਾਂ ਵੀ ਸਾਨੂੰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਇਵੇਂ ਹੀ ਹੋਰ ਵੀ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਜਿਵੇਂ ਕਿ ਪਾਣੀ ਦੀ ਸਮੱਸਿਆ ਹੋ ਗਈ ਲਾਈਟ ਦੀ ਬਿਜਲੀ ਦੀ ਸਮੱਸਿਆ ਕੱਟ ਬਹੁਤ ਜ਼ਿਆਦਾ ਲੱਗਦੇ ਨੇ ਜੋ ਕਿ ਦਿਖਾਉਣਾ ਚਾਹੀਦਾ ਮੀਡੀਆ ਨੂੰ ਉਹ ਨਹੀਂਂ ਦਿਖਾਉਂਦੇ ਜਿਵੇਂ ਪਿੰਡ ਪਿੰਡਾਂ ਦੇ ਵਿੱਚ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਉਨ੍ਹਾਂ ਦੇ ਰੁਜ਼ਗਾਰ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਅਤੇ ਨਾ ਹੀ ਜਿਵੇਂ ਹੋਰ ਵੀ ਬਹੁਤ ਸਮੱਸਿਆ ਨੇ ਬੱਸਾਂ ਦਾ ਟਾਈਮ 'ਤੇ ਨਾ ਆਉਣਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਵੇਂ ਹੀ ਹੋਰ ਜ਼ਿਆਦਾ ਦਿੱਕਤਾਂ ਵੱਧ ਰਹੀਆਂ ਨੇ ਇਸ ਚੀਜ਼ ਨੂੰ ਕੋਈ ਵੀ ਨਹੀਂ ਦਿਖਾ ਰਿਹਾ ਮੀਡੀਆ 'ਤੇ